ਪੰਜਾਬ ਅਸੀਂ ਹੁਣ ਅੱਜ ਗੱਲ ਕਰੀਏ ਪੰਜਾਬ ਸਿਕਸ਼ਾ ਪ੍ਰਣਾਲੀ ਸਕੂਲਾਂ ਵਿੱਚ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ ਅਤੇ ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਪੜ੍ਹੇ ਲਿਖੇ ਬੱਚੇ ਜਾਂ ਐੱਮ ਏ ਬੀਐੱਡ ਕੀਤੀ ਹੋਈ ਜਾਂ ਵੱਡੇ ਪੜ੍ਹੇ ਲਿਖੇ ਟੀਚਰਸ ਨੂੰ ਅਪੁਆਇੰਟ ਕਰਨਾ ਚਾਹੀਦਾ ਪੜ੍ਹੇ ਲਿਖੇ ਟੀਚਰ ਜਿਹੜੇ ਅਪੁਆਇੰਟ ਹੋਣਗੇ ਤਾਂ ਉਹ ਹੀ ਅੱਗੋਂ ਜਿਵੇਂ ਬੱਚਿਆਂ ਨੂੰ ਚੰਗੀ ਸ਼ਿਕਸ਼ਾ ਦੇ ਸਕਣਗੇ ਪਹਿਲਾਂ ਵਾਂਗੂ ਪਹਿਲਾਂ ਜਿਹੜੇ ਹੁੰਦੇ ਸੀ ਕਿ ਬਿਨਾਂ ਕਿਸੇ ਪੜ੍ਹੇ ਲਿਖੇ ਦਸਵੀਂ ਪਾਸ ਬਾਰਵੀਂ ਪਾਸ ਜਾਂ ਘੱਟ ਪੜ੍ਹੇ ਲਿਖੇ ਬੱਚੇ ਸਿੱਧੇ ਹੀ ਔਰ ਟੀਚਰਸ ਭਰਤੀ ਕਰ ਲੈਂਦੇ ਸੀ ਉਹਨਾਂ ਨੇ ਜੇ ਆਪ ਹੀ ਟੀਚਰ ਘੱਟ ਪੜ੍ਹਿਆ ਹੋਵੇਗਾ ਤਾਂ ਉਹ ਬੱਚਿਆਂ ਨੂੰ ਕੀ ਸ਼ਿਕਸ਼ਾ ਦੇਵੇਗਾ ਫੰਡਿੰਗ ਵਿੱਚ ਵੀ ਚਾਹੀਦਾ ਸਰਕਾਰ ਨੂੰ ਫੰਡਿੰਗ ਜਿਹੜੀ ਹੈਗੀ ਹੈ ਉਹ ਵੀ ਦੇਣੀ ਚਾਹੀਦੀ ਹੈ ਹਰ ਸਕੂਲਾਂ ਕਾਲਜਾਂ ਨੂੰ ਹਰ ਕਿਸੇ ਨੂੰ ਜੇ ਫੰਡਿੰਗ ਦੇਣ ਨਾਲ ਉਹ ਬੱਚੇ ਹਰ ਕੋਈ ਬੱਚਾ ਗਰੀਬ ਬੱਚਾ ਵੀ ਜਿਹੜਾ ਹੈ ਨਾ ਉਹ ਉੱਪਰ ਉਠੇਗਾ ਗਰੀਬ ਬੱਚਾ ਵੀ ਮਿਹਨਤ ਕਰਕੇ ਆਪਣੀ ਪੜ੍ਹਾਈ 'ਚ ਖੇਡਾਂ 'ਚ ਨਾਮ ਰੋਸ਼ਨ ਕਰੇਗਾ ਅਤੇ ਜੇ ਸਰਕਾਰ ਉਹਨਾਂ ਨੂੰ ਹੱਲ ਹ ਉਹਨਾਂ ਦਾ ਫੰਡਿੰਗ ਦੇਵੇਗੀ ਅੱਛੀ ਫੰਡਿੰਗ ਦੇਵੇਗੀ ਤਾਂ ਹਰ ਕੋਈ ਸਕੂਲ ਕੋਲਜ ਤਰੱਕੀਆਂ ਕਰਨਗੇ ਸਾਫ਼ ਸੁਥਰੇ ਸਕੂਲ ਹੋਣਗੇ ਹਰ ਇੱਕ ਖੇਡ ਦੇ ਮੈਦਾਨ ਸਾਫ਼ ਸੁਥਰੇ ਠੀਕ ਹੋਣ ਅਤੇ ਉਹਨਾਂ ਨੂੰ ਅੱਛੀ ਤਰ੍ਹਾਂ ਗਾਈਡੈਂਸ ਮਿਲੇ ਤਾਂ ਫਿਰ ਹੀ ਉਹ ਦੇਸ਼ ਦਾ ਨਾਂ ਰੋਸ਼ਨ ਕਰ ਸਕਦੇ ਨੇ ਇਸ ਵਿੱਚ ਸਿਕਸ਼ਾ ਪ੍ਰਣਾਲੀ ਵੀ ਠੀਕ ਹੋਣੀ ਚਾਹੀਦੀ ਹੈ ਸਿਕਸ਼ਾ ਪ੍ਰਣਾਲੀ ਵੀ ਸਾਫ਼ ਸੁਥਰੀ ਹੋਵੇ ਅਤੇ ਜਿਹੜੀ ਹੈਗੀ ਫੰਡਿੰਗ ਵੀ ਉਹ ਵੀ ਸਰਕਾਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਤਾਂ ਕਿ ਹਰ ਕਿ ਬੱਚਾ ਪੜ੍ਹ ਲਿਖੇ ਅਤੇ ਖੇਡਾਂ ਵਿੱਚ ਅੱਗੇ ਵੱਧ ਕੇ ਅਤੇ ਦੇ ਜਿਲ੍ਹੇ ਦਾ ਦੇਸ਼ ਦਾ ਨਾਂ ਇੰਟਰਨੈਸ਼ਨਲ ਲੈਵਲ 'ਤੇ ਉਹਨੂੰ ਆਪਣੇ ਅੱਗੇ ਲਿਜਾ ਸਕੇ ਅਤੇ ਉਹਨਾਂ ਦਾ ਨਾਂ ਰੋਸ਼ਨ ਕਰ ਸਕੇ ਥੈਂਕਸ ਧੰਨਵਾਦ ਜੀ